ਹੈਲੋ ਹਾਂਜੀ ਮੈਮ ਮੈਂ ਤੁਹਾਡਾ ਨਿਊ ਪੜੋਸੀ ਬੋਲ਼ ਰਿਹਾ ਸੀਗਾ ਐਕਚੁਅਲੀ ਮੈਂ ਨਾ ਹਲੇ ਆਪਣੇ ਇੱਧਰ ਸ਼ਿਫਟ ਕਰਿਆ ਏ ਅਤੇ ਅਤੇ ਭਾਅ ਜੀ ਹੈਗੇ ਘਰ ਅੱਛਾ ਮੈਂ ਐਕਚੁਅਲੀ ਇਹ ਪੁੱਛਣਾ ਸੀਗਾ ਨਾ ਜਿਵੇਂ ਉਰੇ ਹੁਣ ਮੈਂ ਨਵਾਂ ਨਵਾਂ ਸ਼ਿਫਟ ਕਰਿਆ ਅਤੇ ਸਬਜ਼ੀਆਂ ਵਗੈਰਾ ਲੈਣੀਆਂ ਸੀਗੀਆ ਵੀ ਕਿੱਥੋਂ ਆਪਾਂ ਠੀਕ ਠੀਕ ਰੇਟ 'ਤੇ ਮਿਲ ਜਾਣ ਵਗੈਰਾ ਕਿਤੇ ਮਾਰਕਿਟ ਵਗੈਰਾ ਕਿੱਥੇ ਕੁ ਨੂੰ ਹੈ ਹਾਂਜੀ ਹਾਂਜੀ ਅੱਛਾ ਜੀ ਅੱਛਾ ਮਤਲਬ ਰੇਟ ਮਤਲਬ ਜਿਵੇਂ ਮੋਲ 'ਚ ਜੈਜ ਹੁੰਦਾ ਏ ਕਿ ਜਿਵੇਂ ਬਾਹਰ ਤੋਂ ਆਪਾਂ ਲਈਏ ਉੱਥੇ ਠੀਕ ਮਿਲ ਜੇਗਾ ਆਪਾਂ ਨੂੰ ਅੱਛਾ ਜੀ ਕੋਈ ਜਿਵੇਂ ਉਰੇ ਉੱਦਾਂ ਵੈਸੇ ਮੰਡੀ ਵਗੈਰਾ ਵੀ ਲੱਗਦੀ ਹੈ ਜਿਵੇਂ ਕਿਸਾਨ ਵ ਮੰਡੀ ਵਗੈਰਾ ਕੁਛ ਜਿਵੇਂ ਬੰਦੇ ਫਰੈਸ਼ ਲੈ ਕੇ ਆਉਂਦੇ ਤੋੜ ਕੇ ਜਿਵੇਂ ਕਿ ਅੱਛਾ ਜ਼ੈਲ ਸਿੰਘ ਇਹ ਇਹਦੇ ਵਾਸਤੇ ਮੈਂ ਕਿੱਥੇ ਜਾਣਾ ਪਏਗਾ ਜਿਵੇਂ ਆਪਾਂ ਬੇਲਾ ਚੌਂਕ ਬੇਲਾ ਚੌਂਕ ਸਾਈਡ ਰਹਿੰਦੇ ਅਤੇ ਕਿੱਥੋਂ ਮਤਲਬ ਟੈਂਪੂ ਵਗੈਰਾ ਕਿੱਥੋਂ ਮਿਲੇਗਾ ਅੱਛਾ ਜੀ ਬਾਕੀ ਹੋਰ ਨੇੜੇ ਤੇੜੇ ਜੇ ਕਰਿਆਨਾ ਸਟੋਰ ਵਗੈਰਾ ਕਿੱਥੇ ਕੁ ਨੂੰ ਨੇ ਅੱਛਾ ਜੀ ਚੱਲੋ ਠੀਕ ਹੈ ਮੈਮ ਥੈਂਕ ਯੂ ਸੋ ਮਚ ਓਕੇ ਜੀ